ਮੈਨੂੰ ਸਭ ਤੋਂ ਵਧੀਆ ਗੇਮ ਲੱਗਦੀ ਹੈ ਕ੍ਰਿਕਟ ਕਿਉਂਕਿ ਕ੍ਰਿਕਟ ਮੈਂ ਸ਼ੁਰੂ ਤੋਂ ਖੇਡਦਾ ਆਇਆ ਵਾਂ ਅਤੇ ਮੈਨੂੰ ਇਹ 'ਚ ਕਾਫ਼ੀ ਇੰਟਰਸਟ ਹੈਗਾ ਇਹ ਮੈਂ ਛੋਟੇ ਹੁੰਦੇ ਤੋਂ ਖੇਡਦਾ ਆਇਆ ਵਾਂ ਅਤੇ ਕਾਫ਼ੀ ਵਧੀਆ ਖੇਡਦਾ ਹੁੰਦਾ ਸੀ ਮੈਂ ਕਾਫ਼ੀ ਮੈਂ ਆਪਣੇ ਫਾਦਰ ਨਾਲ਼ ਵੀ ਖੇਡਦਾ ਰਿਹਾ ਕ੍ਰਿਕਟ ਅਲੱ ਅਲ਼ ਅਲੱਗ ਅਲੱਗ ਗਰਾਊਂਡ 'ਚ ਜਾ ਖੇਡਦਾ ਰਿਹਾ ਕ੍ਰਿਕਟ ਕ੍ਰਿਕਟ ਵਿੱਚ ਮੇਰਾ ਸਭ ਤੋਂ ਫੇਵਰੇਟ ਖਿਡਾਰੀ ਵਿਰਾਟ ਕੋਹਲੀ ਵਿਰਾਟ ਕੋਹਲੀ ਮੇਰਾ ਸ਼ੁਰੂ ਤੋਂ ਹੀ ਫੇਵਰੇਟ ਰਿਹਾ ਵਾ ਉਹਦੀ ਆਈ ਪੀ ਐਲ ਟੀਮ ਹੈ ਜਿਹੜੀ ਆਰ ਸੀ ਬੀ ਉਹ ਵੀ ਮੇਰੀ ਕਾਫ਼ੀ ਫੇਵਰੇਟ ਟੀਮ ਹੈਗੀ ਹੈ ਕ੍ਰਿਕਟ ਦਾ ਸ਼ੌਕ ਮੈਨੂੰ ਬਚਪਨ ਤੋਂ ਇਸ ਕਰਕੇ ਵੀ ਸੀ ਕਿਉਂਕਿ ਮੇਰੇ ਯਾਰ ਦੋਸਤ ਸੀ ਜਿਹੜੇ ਉਹ ਜਾਂਦੇ ਰਹਿੰਦੇ ਸੀ ਖੇਡਣ ਅਤੇ ਮੈਨੂੰ ਵੀ ਉਹਨਾਂ ਨਾਲ਼ ਜਾ ਜਾ ਕੇ ਸ਼ੌਕ ਪੈ ਗਿਆ ਕ੍ਰਿਕਟ ਖੇਡਣ ਦਾ ਅਤੇ ਮੈਨੂੰ ਕਾਫ਼ੀ ਮਜ਼ਾ ਆਉਂਦਾ ਸੀ ਕ੍ਰਿਕਟ ਖੇਡਣ ਦਾ ਨਾਲ਼ੇ ਜਿਹੜਾ ਸਟ੍ਰੈੱਸ ਸਟਰੁੱਸ ਸੀ ਸਾਰਾ ਖ਼ਤਮ ਹੋ ਜਾਂਦਾ ਸੀ ਇਸ ਕਰਕੇ ਮੈਨੂੰ ਕ੍ਰਿਕਟ ਬਹੁਤ ਅੱਛਾ ਲੱਗਦਾ ਉਹਦੇ ਵਿੱਚ ਤੁਹਾਡੀ ਲਾਈਫ ਦਾ ਇੱਕ ਤੁਹਾਡਾ ਮੋਟਿਵ ਆ ਕਿ ਤੁਸੀਂ ਕ੍ਰਿਕਟ ਦੇ ਵਿੱਚ ਅੱਗੇ ਜਾਣਾ ਪਰ ਉਹ ਇਸ ਕਰਕੇ ਨਹੀਂ ਜਾਇਆ ਜਾ ਸਕਦਾ ਕਿਉਂਕਿ ਫਾਈਨੈਂਸ਼ਲੀ ਨਹੀਂ ਸਹੀ ਹੈਗੇ ਇਸ ਕਰਕੇ ਕ੍ਰਿਕਟ ਮੈਂ ਥੋੜ੍ਹਾ ਹੁਣ ਛੱਡਤਾ ਪਰ ਅੱਜ ਵੀ ਮੈਂ ਕ੍ਰਿਕਟ ਬਿਲਕੁਲ ਫੇਵਰੇਟ ਚੀਜ਼ ਹੈਗੀ ਆ ਮੈਨੂੰ ਕਾਫ਼ੀ ਮਜ਼ਾ ਆਉਂਦਾ ਖੇਡ ਕੇ ਅੱਜ ਵੀ ਮੈਂ ਆਪਣੇ ਦੋਸਤਾਂ ਨਾਲ਼ ਜਾਂਦਾ ਰਹਿੰਦਾ ਵਾ ਅਲੱਗ ਅਲੱਗ ਜਗ੍ਹਾ 'ਤੇ ਖੇਡਣ ਵਾਸਤੇ ਅਤੇ ਉਹਨਾਂ ਨਾਲ਼ ਗੱਲਾਂ ਬਾਤਾਂ ਕਰਕੇ ਇੱਕ ਅਲੱਗ ਜਿਹੀ ਵਾਈਵ ਆਉਂਦੀ ਆ ਅਲੱਗ ਜਿਹੀ ਮਤਲਬ ਕਿ ਇੱਕ ਸਟ੍ਰੈੱਸ ਆਪਣਾ ਖ਼ਤਮ ਹੋ ਜਾਂਦਾ ਕ੍ਰਿਕਟ ਖੇਡ ਖੇਡ ਕੇ ਕ੍ਰਿਕਟ ਇੱਕ ਬੜੀ ਵਧੀਆ ਗੇਮ ਹੈਗੀ ਹੈ ਇਸ ਕਰਕੇ ਕ੍ਰਿਕਟ ਸਾਰਿਆਂ ਨੂੰ ਖੇਡਣਾ ਚਾਹੀਦਾ ਮੇਰਾ ਵਿਰਾਟ ਕੋਹਲੀ ਹਮੇਸ਼ਾ ਤੋਂ ਫੈਨ